ਹਾਂ ਸਿੰਪੀ ਹਾਂਜੀ ਕਿਵੇਂ ਹਾਂ ਹੋਰ ਘਰ ਕਿਵੇਂ ਨੇ ਵਧੀਆ ਉਹ ਨਾ ਮੈਂ ਤੇਰੇ ਤੋਂ ਐਂ ਪੁੱਛਣਾ ਸੀਗਾ ਵੀ ਮੈਂ ਮੈਂ ਜਾਨਣਾ ਸੀ ਵੀ ਮਾਨਸਾ ਜ਼ਿਲ੍ਹੇ ਵਿੱਚ ਕਿਹੜੇ ਕਿਹੜੇ ਕੋਚਿੰਗ ਸੈਂਟਰ ਨੇ ਗੇ ਜਿਹੜੇ ਵਧੀਆ ਨੇਗੇ ਹਾਂਜੀ ਮੈਂ ਪਲਸ ਟੂ ਕਲੀਅਰ ਕਰ ਲਈ ਅਤੇ ਹੁਣ ਮੈਂ ਕੋਚਿੰਗ ਸੈਂਟਰ 'ਚ ਲੱਗਣਾ ਸੀਗਾ ਤਾਂ ਫਿਰ ਮੈਨੂੰ ਤੁਹਾਡੀ ਯਾਦ ਆਈ ਵੀ ਤੁਸੀਂ ਪਹਿਲਾਂ ਲੱਗੇ ਵੇ ਸੀ ਨਾ ਮੈਨੂੰ ਦੱਸਿਆ ਸੀ ਤੁਸੀਂ ਅਤੇ ਮੈਂ ਤਾਂ ਕਰਕੇ ਤੁਹਾਡੇ ਤੋਂ ਪੁੱਛ ਰਹੀ ਹਾਂ ਹਾਂਜੀ ਹਾਂਜੀ ਹਾਂਜੀ ਅਤੇ ਫੀਸ ਵਗੈਰਾ ਦਾ ਕਿਵੇਂ ਉੱਥੇ ਡੇਮੋ ਵਗੈਰਾ ਦੇ ਦਿੰਦੇ ਉਹ ਪਹਿਲਾਂ ਹਾਂਜੀ ਕੋਈ ਗੱਲ ਨਹੀਂ ਫਿਰ ਤਾਂ ਮੈਂ ਆਪਣੇ ਫਰੈਂਡਾਂ ਨੂੰ ਵੀ ਕਹਿ ਦੂੰਗੀ ਜੀ ਪਹਿਲਾਂ ਮੈਂ ਜਾ ਕੇ ਦੇਖ ਆਊਂਗੀ ਜੇ ਮੈਨੂੰ ਵਧੀਆ ਲੱਗਿਆ ਤਾਂ ਮੈਂ ਆਪਣੇ ਫਰੈਂਡਾਂ ਨੂੰ ਕਹਿ ਲੂੰ ਉਹਨਾਂ ਨੇ ਵੀ ਲੱਗਣਾ ਸੀਗਾ ਤਾਂ ਫਿਰ ਅਸੀਂ ਆ ਜਾਵਾਂਗੇ ਇੱਕ ਦਿਨ ਠੀਕ ਹੋਰ ਫਿਰ ਹਾਂਜੀ ਉਹਨਾਂ ਨੇ ਵੀ ਕਰ ਲਈ ਅਤੇ ਉਹਨਾਂ ਨੇ ਵੀ ਦੱਸਿਆ ਕਿਹਾ ਮੈਨੂੰ ਵੀ ਦੇਖ ਲਈ ਉਹਨਾਂ ਵਿੱਚੋਂ ਤੇਰੀ ਜਾਣ ਪਛਾਣ 'ਚ ਕੋਈ ਹੋਇਆ ਤਾਂ ਵੀ ਮੈਨੂੰ ਦੱਸ ਦਿਓ ਵੀ ਆਪਾਂ ਇਕੱਠੇ ਲੱਗ ਜਾਂਗੇ ਠੀਕ ਹੈ ਉਹ ਹੀ ਸੈਂਟਰ ਹੈ ਨਾ ਜਿਹੜਾ ਬੱਸ ਸਟੈਂਡ ਦੇ ਨੇੜੇ ਪੈਂਦਾ ਹਾਂਜੀ ਹਾਂਜੀ ਨਹੀਂ ਮੈਂ ਤੁਹਾਡੇ ਤੋਂ ਬਸ ਐਂਈ ਪੁੱਛਣਾ ਸੀ ਮੈਨੂੰ ਕੋਈ ਨਾ ਗਾਈਡ ਕਰਨ ਵਾਲਾ ਨਹੀਂ ਹੈਗਾ ਸੀ ਤਾਂ ਕਰਕੇ ਫਿਰ ਮੈਨੂੰ ਤੁਹਾਡੀ ਯਾਦ ਆਈ ਵੀ ਤੁਸੀਂ ਮੈਨੂੰ ਉਸ ਦਿਨ ਦੱਸਿਆ ਸੀ ਨਾ ਵੀ ਮੈਂ ਵੀ ਕੋਚਿੰਗ ਸੈਂਟਰ 'ਚ ਲੱਗੀ ਵੀ ਹੈਗੀ ਅਤੇ ਤਾਂ ਕਰਕੇ ਫਿਰ ਮੈਨੂੰ ਮੈਨੂੰ ਐਂ ਹੋਇਆ ਵੀ ਤੁਹਾਨੂੰ ਪੁੱਛਾਂ ਮੈਂ ਵੀ ਤੁਸੀਂ ਕਿਹੜੇ ਸੈਂਟਰ 'ਚ ਸੀਗੇ ਹਾਂਜੀ ਹਾਂਜੀ ਕੋਈ ਗੱਲ ਨਹੀਂ ਫਿਰ ਮੈਂ ਆਪਣੇ ਪੇਰੈਂਟਸ ਨੂੰ ਲੈ ਜੂੰਗੀ ਕੇਰਾਂ ਉੱਥੇ ਜਾ ਕੇ ਦੇਖ ਆਊਂਗੀ ਜਿਵੇਂ ਮੈਨੂੰ ਮਾਹੌਲ ਵਧੀਆ ਲੱਗਿਆ ਉੱਥੋਂ ਦਾ ਤਾਂ ਫਿਰ ਮੈਨੇ ਉੱਥੇ ਐਡਮਿਸ਼ਨ ਕਰਵਾ ਆਊਂਗੀ ਹਾਂਜੀ ਮੈਂ ਆਪਣੇ ਫਰੈਂਡਾਂ ਨੂੰ ਵੀ ਕਹਿ ਦੂੰਗੀ ਉਹ ਵੀ ਉੱਥੇ ਜਾ ਆਉਣਗੀਆ ਹਾਂਜੀ ਚਲੋ ਠੀਕ ਹੈ ਥੈਂਕ ਯੂ ਸੋ ਮੱਚ ਬਾਏ ਬਾਏ